ਅਸੀਂ ਸਮਾਜ ਦੇ ਵਿੱਚ ਇਹ ਪ੍ਰਚਾਰ ਕਰਨਾ ਚਾਹੁੰਦੇ ਹਾਂ ਕਿ ਜੋ ਇਨਸਾਨੀਅਤ ਹੈ ਸੰਸਾਰ ਦੇ ਵਿੱਚ ਇਨਸਾਨੀਅਤ ਇਨਸਾਨ ਜੋ ਧਰਮਾਂ ਦੇ ਨਾਂ 'ਤੇ ਜੋ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਦੇ ਹਨ ਅਸੀਂ ਇਹ ਨਹੀਂ ਚਾਹੁੰਦੇ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਇਨਸਾਨਾਂ ਨੂੰ ਆਪ ਦੇ ਵਿੱਚ ਬੜੀ ਹਲੀਮੀ ਦੇ ਨਾਲ ਪ੍ਰੇਮ ਦੇ ਨਾਲ ਲਿਆਕਤ ਦੇ ਨਾਲ ਸਤਿਕਾਰ ਦੇ ਨਾਲ ਸੰਸਾਰ ਵਿੱਚ ਵਿਚਰਨਾ ਚਾਹੀਦਾ ਹੈ ਰਹਿਣਾ ਚਾਹੀਦਾ ਹੈ ਅਤੇ ਜੋ ਇਸਤਰੀ ਜਾਤੀ ਹੈ ਸੋ ਇਸ ਦਾ ਵੀ ਸਤਿਕਾਰ ਹੋਣਾ ਚਾਹੀਦਾ ਜਿਵੇਂ ਭਰੂਣ ਹੱਤਿਆ ਕਹਿ ਕੇ ਛੋਟੀਆਂ ਬੱਚੀਆਂ ਨੂੰ ਜੋ ਬਹੁਤ ਲੋਕ ਹਨ ਜੋ ਗਰਭ ਦੇ ਵਿੱਚ ਹੀ ਖਤਮ ਕਰ ਦਿੰਦੇ ਹਨ ਸੋ ਸੰਸਾਰ ਦੇ ਵਿੱਚ ਜੋ ਨਸ਼ਾ ਹੈ ਨਸ਼ੇ ਤੋਂ ਮੁਕਤ ਸਮਾਜ ਚਾਹੁੰਦੇ ਹਾਂ ਅਤੇ ਜੋ ਵੀ ਸੰਸਾਰ ਦੇ ਵਿੱਚ ਪਵਿੱਤਰ ਜੋ ਰਿਸ਼ਤੇ ਹਨ ਉਹ ਪਵਿੱਤਰ ਹੀ ਹੋਣੇ ਚਾਹੀਦੇ ਹਨ ਅਸੀਂ ਸਮਾਜ ਦੇ ਵਿੱਚ ਚਾਹੁੰਦੇ ਹਾਂ ਕਿ ਇਨਸਾਨ ਨੇ ਜੋ ਉਹ ਇਨਸਾਨਾਂ ਵਾਲੇ ਹੀ ਕੰਮ ਕਰਨ ਜੋ ਆਪਸੀ ਪ੍ਰੇਮ ਪਿਆਰ ਦੇ ਨਾਲ ਜੋ ਜ਼ਿੰਦਗੀ ਹੈ ਬਤੀਤ ਕਰਨ ਸਭ ਦੇ ਇੱਕ ਦੂਜੇ ਦੇ ਮਿਲਵਰਤਨ ਦੇ ਵਿੱਚ ਰਹਿ ਕੇ ਪ੍ਰੇਮ ਦੇ ਵਿੱਚ ਰਹਿ ਕੇ ਜੋ ਜ਼ਿੰਦਗੀ ਬਤੀਤ ਕਰਨ ਅਸੀਂ ਇਹ ਸਮਾਜ ਦੇ ਵਿੱਚ ਇਹੋ ਜਿਹਾ ਇਨਸਾਫ ਚਾਹੁੰਦੇ ਹਾਂ